ਸਤਿ ਸ਼੍ਰੀ ਅਕਾਲ ਭਾਜੀ ਮੈਂ ਬਲਜੀਤ ਸਿੰਘ ਮੋਹਾਲੀ ਫੇਜ਼ ਸੱਤ ਤੋਂ ਬੋਲਦਾ ਹਾਂ ਅਤੇ ਮੈਂ ਤੁਹਾਡੀ ਦੁਕਾਨ ਤੋਂ ਕੱਪੜੇ ਓਡਰ ਕੀਤੇ ਸੀ ਜਿਨ੍ਹਾਂ ਵਿੱਚ ਟੀ ਸ਼ਰਟਾਂ ਲੋਅਰ ਪੈਂਟਾਂ ਅਤੇ ਹੋਰ ਵੀ ਕੁਝ ਹੋਰ ਆਈਟਮਾਂ ਵੀ ਹੈ ਅਤੇ ਉਹ ਮੈਨੂੰ ਬਹੁਤ ਹੀ ਪਸੰਦ ਆਏ ਨੇ ਅਤੇ ਉਨ੍ਹਾਂ ਦਾ ਕਲਰ ਕੋਮਬੀਨੇਸ਼ਨ ਵੀ ਬਹੁਤ ਵਧੀਆ ਅਤੇ ਮੇਰੇ ਯਾਰਾਂ ਦੋਸਤਾਂ ਨੂੰ ਵੀ ਬਹੁਤ ਹੀ ਪਸੰਦ ਆਏ ਹਨ ਇਹ ਕੱਪੜੇ ਅਤੇ ਉਹ ਮੈਨੂੰ ਪੁੱਛਦੇ ਸੀ ਵੀ ਤੈਂ ਕਿੱਥੋਂ ਮੰਗਵਾਏ ਅਤੇ ਮੈਂ ਉਨ੍ਹਾਂ ਨੂੰ ਤੁਹਾਡਾ ਐਡਰੈੱਸ ਦੇ ਦਿੱਤਾ ਹੈ ਅਤੇ ਉਹ ਇਸ ਵਿੱਚੋਂ ਮੈਨੂੰ ਇੱਕ ਕੁਪਨ ਪ੍ਰਾਪਤ ਹੋਇਆ ਹੈ ਅਤੇ ਮੈਂ ਇਸ ਕਰਕੇ ਤੁਹਾਨੂੰ ਇੱਕ ਓਡਰ ਹੋਰ ਦੇ ਰਿਹਾ ਹਾਂ ਅਤੇ ਇਹ ਕੁਪਨ ਮੈਨੂੰ ਡਿਸਕਾਊਂਟ ਕਰਕੇ ਇਸ ਵਿੱਚੋਂ ਮੇਰੇ ਪਤੇੇ 'ਤੇ ਭੇਜ ਦਿਓ ਅਤੇ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿਉਂਕਿ ਤੁਹਾਡਾ ਓਡਰ ਦੇਣ ਦਾ ਤਰੀਕਾ ਬਹੁਤ ਹੀ ਵਧੀਆ ਸੀ ਅਤੇ ਵਧੀਆ ਸੀ ਅਤੇ ਮੇਰੇ ਯਾਰਾਂ ਦੋਸਤਾਂ ਨੂੰ ਵੀ ਤੁਹਾਡੀ ਡਿਲੀਵਰੀ ਦਾ ਅਤੇ ਤੁਹਾਡੀ ਜੋ ਵੀ ਬਰੈਂਡਡ ਕੱਪੜੇ ਬਹੁਤ ਹੀ ਪਸੰਦ ਆਏ ਨੇ ਅਤੇ ਕਿਰਪਾ ਕਰਕੇ ਇਸ ਨੂੰ ਮੇਰੇ ਪਤੇ 'ਤੇੇ ਭੇਜ ਦਿਓ ਅਤੇ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਤੁਹਾਡਾ ਐਡਰੈੱਸ ਦੇ ਦਿੱਤਾ ਹੈ